ਹਾਂ ਅਸੀਂ ਉਹਨਾਂ ਉਦਾਹਰਨਾਂ ਦਾ ਵਰਨਣ ਕਰ ਸਕਦੇ ਹਾਂ ਜਿੱਥੇ ਸਾਡੇ ਸਥਾਨ ਦੀਆਂ ਕਲਾਵਾਂ ਅਤੇ ਸ਼ਿਲਪਕਾਰੀ ਫਿਲਮਾਂ ਇਸ਼ਤਿਹਾਰ ਵਾਜੀਆਂ ਵਿੱਚ ਵਰਤੇ ਗਏ ਜਿਵੇਂ ਕਿ ਹੜੱਪਾ ਦੀ ਸੱਭਿਅਤਾ ਵਿਰਾਸਤ ਏ ਖਾਲਸਾ ਭੰਗੜਾ ਗੱਤਕਾ ਗਿੱਧਾ ਇਨ੍ਹਾਂ ਨੂੰ ਫਿਲਮਾਂ ਵਿੱਚ ਦਿਖਾਇਆ ਗਿਆ ਹੈ